ਸਤਿ ਸ਼੍ਰੀ ਅਕਾਲ ਜੀ ਮੈਂ ਭਾਵੀਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਨੂੰ ਆਪਣੇ ਕੁਝ ਸਥਾਨਕ ਸੱਭਿਆਚਾਰਕ ਦੱਸਾਂਗੀ ਜੋ ਕਿ ਸੈਲਾਨੀ ਪੰਜਾਬ ਤੋਂ ਜਾਣ ਵਾਲੇ ਅਜਮਾ ਸਕਦੇ ਹਨ ਪੰਜਾਬ ਦੇ ਸੱਭਿਆਚਾਰ ਬਾਰੇ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪੰਜਾਬੀ ਸੱਭਿਆਚਾਰ ਕਿੰਨਾ ਵਿਸ਼ਾਲ ਹੈ ਸਾਡੇ ਪੰਜਾਬ ਦਾ ਸੱਭਿਆਚਾਰ ਬਾਕੀ ਸਾਰੇ ਦੇਸ਼ ਅਤੇ ਜ਼ਿਲ੍ਹਿਆਂ ਤੋਂ ਬਹੁਤ ਹੀ ਵਿਲੱਖਣ ਹੈ ਕਿਉਂਕਿ ਸਾਡੇ ਪੰਜਾਬ ਦੇ ਲੋਕ ਬਹੁਤ ਹੀ ਵਿਲੱਖਣ ਹਨ ਪੰਜਾਬ ਰਹਿਣ ਸਹਿਣ ਅਤੇ ਖਾਣ ਪੀਣ ਵਿੱਚ ਬਹੁਤ ਮਸ਼ਹੂਰ ਹੈ ਬਾਕੀ ਜਿਵੇਂ ਸਾਡੇ ਪੰਜਾਬ ਵਿੱਚ ਕਈ ਬਾਹਰਲੇ ਦੇਸ਼ ਦੇ ਲੋਕ ਆਉਂਦੇ ਹਨ ਜਿਵੇਂ ਯਾਤਰੀ ਉਹ ਹਿੰਦੂ ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਆਉਣਾ ਪਸੰਦ ਕਰਦੇ ਹਨ ਕਿਉਂਕਿ ਇੱਥੋਂ ਦੇ ਲੋਕ ਬਹੁਤ ਹੀ ਚੰਗੇ ਹਨ ਲੋਕ ਲੋਕਾਂ ਵਿੱਚ ਬੜਾ ਹੀ ਭਾਈਚਾਰਾ ਹੈ ਜਿਵੇਂ ਕਿ ਜਦੋਂ ਕੋਈ ਇੱਥੇ ਆਉਂਦਾ ਹੈ ਸਭ ਤੋਂ ਪਹਿਲਾਂ ਤਾਂ ਲੋਕ ਉਹਨਾਂ ਦਾ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕਰਦੇ ਹਨ ਉਹਨਾਂ ਦੇ ਗਲੇ ਵਿੱਚ ਹਾਰ ਪਾਉਂਦੇ ਹਨ ਅਤੇ ਮੂੰਹ ਮਿੱਠਾ ਕਰਾਉਂਦੇ ਹਨ ਅਤੇ ਫਿਰ ਉਹਨਾਂ ਨੂੰ ਪੰਜਾਬ ਦੇ ਰੀਤੀ ਰਿਵਾਜ਼ਾਂ ਅਤੇ ਤਿਉਹਾਰਾਂ ਬਾਰੇ ਦੱਸਦੇ ਹਨ ਜਿਵੇਂ ਕਿ ਦੀਵਾਲੀ ਲੋਹੜੀ ਮਾਘੀ ਸੰਗਰਾਂਦ ਆਦਿ ਕਿੱਦਾਂ ਮਨਾਏ ਜਾਂਦੇ ਹਨ ਨਾਲ ਇਹਨਾਂ ਨੂੰ ਪੰਜਾਬ ਦੀਆਂ ਖਾਸ ਪੌਸ਼ਾਕਾਂ ਅਤੇ ਖਾਣ ਪੀਣ ਬਾਰੇ ਦੱਸਦੇ ਹਨ ਲੋਕ ਪੰਜਾਬ ਦਾ ਸਾਗ ਢੋਡਾ ਅਤੇ ਠੰਢੀ ਠੰਢੀ ਲੱਸੀ ਬਹੁਤ ਪਸੰਦ ਕਰਦੇ ਹਨ ਧੰਨਵਾਦ